ਮੇਰੇ ਵੱਡੇ ਦੀਦੀ ਦੇ ਵਿਆਹ ਦੇ ਤੋਹਫੇ ਦੀ ਲਿੱਤੀ ਹੋਏ ਅਸੀਂ ਬਹੁਤ ਕੁਝ ਦਿੱਤਾ ਆਪਣੇ ਹੱਥਾਂ ਨਾਲ ਬਣਾ ਕੇ ਜਿਵੇਂ ਕਿ ਉਸ ਟਾਈਮ ਕਰੋਸ਼ੀਆ ਸਿਲਾਈਆਂ ਉੱਨ ਲੈ ਕੇ ਅਤੇ ਰੰਗ ਬਿਰੰਗੇ ਧਾਗਿਆਂ ਨੂੰ ਲੈ ਕੇ ਸਾਨੂੰ ਸਭ ਨੂੰ ਚਾਅ ਹੁੰਦਾ ਸੀ ਅਤੇ ਅਸੀਂ ਦੀਦੀ ਦੇ ਵਿਆਹ ਤੋਂ ਛੇ ਮਹੀਨੇ ਪਹਿਲਾਂ ਹੀ ਸਾਰੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਕਿ ਅਸੀਂ ਹੱਥਾਂ ਦੇ ਨਾਲ ਪੱਖੀਆਂ ਬਣਾਈਆਂ ਫਿਰ ਕਰੋਸ਼ੀਏ ਦੇ ਨਾਲ ਟੀਵੀ ਕਵਰ ਫਰਿੱਜ ਕਵਰ ਸ਼ੀਸ਼ੇ ਦਾ ਕਵਰ ਬੈੱਡਸ਼ੀਟ ਟੇਬਲ ਕਵਰ ਹੋਰ ਕਾਫੀ ਚੀਜ਼ਾਂ ਜੋ ਕਿ ਅਸੀਂ ਹੱਥ ਦੇ ਨਾਲ ਬੁਨੀਆ ਮੇਰੇ ਦੀਦੀ ਨੇ ਮੈਂ ਮੇਰੇ ਮੰਮਾ ਨੇ ਮੇਰੀ ਚਾਚੀ ਨੇ ਸਭ ਨੇ ਅਸੀਂ ਰਲ ਮਿਲ ਕੇ ਦੀਦੀ ਦੇ ਦਾਜ ਦੀ ਬਰੀ ਬਣਾਈ ਉਸ ਦੇ ਵਿੱਚ ਜੋ ਵੀ ਉਹਨਾਂ ਨੂੰ ਗਿਫਟ ਦੇਣੇ ਸੀ ਜਿਵੇਂ ਕਿ ਜੈਕਟਾਂ ਕੋਟੀਆਂ ਹੋਰ ਉਹਨਾਂ ਦੀ ਸਾਸੂ ਮਾਂ ਸਸੁਰ ਜੀ ਵਾਸਤੇ ਜੋ ਵੀ ਅਸੀਂ ਉਹਨਾਂ ਨੂੰ ਵਿਆਹ 'ਚ ਤੋਹਫੇ ਦੇਣੇ ਸੀ ਅਸੀਂ ਉਹ ਵੀ ਆਪਣੇ ਹੱਥ ਦੇ ਨਾਲ ਬੁਣਾਏ ਜਦੋਂ ਉਹਨਾਂ ਦੀ ਮੈਰਿਜ ਹੋ ਗਈ ਅਤੇ ਉਹਨਾਂ ਨੂੰ ਉਹ ਗਿਫਟ ਬਹੁਤ ਪਸੰਦ ਆਏ ਅਤੇ ਉਹਨਾਂ ਨੇ ਸਾਨੂੰ ਥੈਂਕ ਯੂ ਕੀਤਾ ਕਿ ਤੁਸੀਂ ਆਪਣੇ ਇੰਨਾਂ ਟਾਈਮ ਲਗਾ ਕੇ ਹੱਥ ਦੀਆਂ ਬੁਣੀਆਂ ਉਹਨਾਂ ਨੇ ਸਾਡੇ ਤਾਰੀਫ ਬਹੁਤ ਕੀਤੀ ਕਿ ਜੋ ਵੀ ਹੱਥਾਂ ਦੇ ਬੁਣਤੀ ਹੁੰਦੀ ਆ ਉਹ ਬਹੁਤ ਅੱਛੀ ਸੀਗੀ ਅਤੇ ਚਲੋ ਟਾਈਮ ਤਾਂ ਲੱਗਦਾ ਪਰ ਜਿਹੜਾ ਉਹਨਾਂ ਨੂੰ ਪਿਆਰ ਨਿੱਘ ਕੀ ਹਾਂ ਵੀ ਇਹਨਾਂ ਨੇ ਸਾਨੂੰ ਹੱਥ ਦੇ ਨਾਲ ਬੁਣਾਈ ਕਰਕੇ ਦਿੱਤੀ ਅਤੇ ਉਹਨਾਂ ਨੇ ਸਾਡਾ ਬਹੁਤ ਬਹੁਤ ਧੰਨਵਾਦ ਕੀਤਾ ਉਸ ਤੋਂ ਬਾਅਦ ਜਦੋਂ ਮੇਰੀ ਦੀਦੀ ਦੇ ਬੇਟਾ ਹੋਇਆ ਅਤੇ ਉਸ ਤੋਂ ਬਾਅਦ ਫਿਰ ਅਸੀਂ ਬੇਟੇ ਨੂੰ ਮੇਰੀ ਮੰਮਾ ਨੇ ਚਾਅ ਚਾਅ ਦੇ ਨਾਲ ਨਾਨੀ ਦੇ ਚਾਅ ਦੇ ਵਿੱਚ ਸਵੈਟਰਾਂ ਕੋਟੀਆਂ ਪਜਾਮੀਆਂ ਫਿਰ ਬੂਟ ਟੋਪੀ ਸੈੱਟ ਜਿਹੜਾ ਹੁੰਦਾ ਵੈ ਉਹ ਸਭ ਕੁਝ ਆਪਣੇ ਹੱਥਾਂ ਨਾਲ ਬਣਾ ਕੇ ਦਿੱਤਾ ਅਤੇ ਸਭ ਨੂੰ ਚਾਅ ਸੀ ਕਿ ਹਾਂ ਅਸੀਂ ਨਾਨਕਾ ਸ਼ੱਕ ਲੈ ਕੇ ਜਾਣਾ ਅਤੇ ਅਸੀਂ ਉਹ ਸਭ ਕੁਝ ਆਪਣੇ ਹੱਥਾਂ ਨਾਲ ਬਣਾ ਕੇ ਤਿਆਰ ਕਰਕੇ ਅਤੇ ਉਹਨਾਂ ਨੂੰ ਉਹ ਸਭ ਕੁਝ ਗਿਫਟ ਦੇ ਵਿੱਚ ਦਿੱਤਾ ਧੰਨਵਾਦ